ਹੈਲੋ ਡੈਂਟਲ ਵਰਕਰ ਬੋਲਦੇ ਹੋ ਸਰ ਤੁਸੀਂ ਨਮਸਤੇ ਸਰ ਸਰ ਸਾਡੇ ਨਾ ਪ੍ਰੋਬਲਮ ਹੈਗੀ ਹੈ ਹਾਂਜੀ ਅਤੇ ਅਪੁਆਇੰਟਮੈਂਟ ਲੈਣੀ ਸੀਗੀ ਡੈਂਟ ਡੋਕਟਰ ਤੋਂ ਹਾਂਜੀ ਸਰ ਸਰ ਮੇਰੇ ਨਾ ਦੋ ਤਿੰਨ ਦਿਨ ਤੋਂ ਦੰਦ 'ਚ ਦਰਦ ਹੈ ਉੱਪਰ ਵਾਲੇ 'ਚ ਹਾਂਜੀ ਅਤੇ ਪੇਨ ਕਿਲਰ ਵੀ ਲੈ ਲਈਆਂ ਸੀਗੀਆਂ ਬਾਕੀ ਫ਼ਰਕ ਨਹੀਂ ਪੈ ਰਿਹਾ ਹਾਂਜੀ ਅਤੇ ਉਹ ਨਾ ਉੱਪਰੋਂ ਪੂਰੀ ਵਿੱਚੋਂ ਦੀ ਕਾਲੀ ਹੋ ਰੱਖੀ ਹੈ ਕੀੜਾ ਲੱਗਿਆ ਹੈ ਹਾਂਜੀ ਅਤੇ ਬਹੁਤ ਹੀ ਜ਼ਿਆਦਾ ਦਰਦ ਹੁੰਦੀ ਆ ਅਸਹਿਣਸ਼ੀਲ ਮਤਲਬ ਨਾ ਕੁਝ ਖਾ ਹੁੰਦਾ ਅਤੇ ਪਾਣੀ ਪੀਂਦੀ ਹਾਂ ਤਾਂ ਉਹ ਵੀ ਠੰਡਾ ਲੱਗਦਾ ਹਾਂਜੀ ਅਤੇ ਕੁਝ ਸਰ ਅੱਜ ਨਹੀਂ ਹੋ ਸਕਦਾ ਰਾਤ ਨੂੰ ਜਾਂ ਸਰ ਮੇਰੇ ਪੇਨ ਬਹੁਤ ਜ਼ਿਆਦਾ ਹੈ ਹਾਂਜੀ ਸਰ ਦੇਖ ਲਓ ਜੇ ਹੋਰ ਹੋ ਸਕਦਾ ਤਾਂ ਜਲਦੀ ਅੱਛਾ ਜੀ ਵੈਸੇ ਕਿੰਨੀ ਫੀਸ ਹੁੰਦੀ ਹੈ ਪਰ ਪਰਸਨ ਔਖੇ ਅਤੇ ਜ ਅੱਛਾ ਜੀ ਮਤਲਬ ਹੋ ਸਕਦਾ ਅੱਜ ਅੱਜ ਦੀ ਡੇਟ 'ਚ ਓਕੇ ਸਰ ਸਰ ਫਿਰ ਵੀ ਭਰਵਾ ਹੀ ਦਿਓ ਮੇਰੇ ਨਾ ਜ਼ਿਆਦਾ ਪੇਨ ਹਾਂਜੀ ਹਾਂਜੀ ਹਾਂਜੀ ਸਰ ਉਹ ਬਾਕੀ ਦੰਦਾਂ 'ਚ ਵੀ ਨਾ ਮੇਰੇ ਥੋੜ੍ਹੇ ਪ੍ਰੋਬਲਮ ਆ ਰਹੀ ਹੈ ਪਿਛਲੀਆਂ ਜੜ੍ਹਾਂ ਵਿੱਚ ਹਾਂਜੀ ਉੱਧਰ ਵੀ ਕੈਵਿਟੀ ਹੋ ਰੱਖੀ ਹੈ ਹਾਂਜੀ ਵੀ ਉਹਦਾ ਵੀ ਹੋ ਜੇਗਾ ਨਾਲ ਫਿਰ ਪਹਿਲਾਂ ਹੀ ਡੈਡ ਵਗੈਰਾ ਹੋ ਜਾਂਦੀ ਹੈ ਇੱਧਰ ਜੜ੍ਹਾਂ ਹਾਂਜੀ ਜ ਇਹ ਤਾਂ ਜ਼ਿਆਦਾ ਦਰਦ ਇਹ ਤਾਂ ਕੱਢਣੀ ਪਏਗੀ ਫਿਰ ਦਵਾਈ ਨਾਲ ਵੀ ਹੈ ਨਾ

ਠੀਕ ਠੀਕ ਹੈ ਜੀ ਠੀਕ ਹੈ ਵੈਸੇ ਮੈਨੂੰ ਵੀ ਇਹ ਹੁੰਦਾ ਕਿ ਨਾ ਪੱਟਣੀ ਪੈ ਪਵੇ ਚਲੋ ਕੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਆਹ ਤਾਂ ਤੁਹਾਡੀ ਗੱਲ ਸਹੀ ਆ ਠੀਕ ਹੈ ਜੀ ਕੋਈ ਅੱਜ ਸਪੈਸ਼ਲੀ ਕਰ ਦਿਓ ਤੁਸੀਂ ਸਪੈਸ਼ਲ ਦੀ ਕਰ ਦਿਓ ਠੀਕ ਠੀਕ ਥੈਂਕ ਯੂ ਸਰ